ਬੈਂਕ ਵਿੱਚ ਸਾਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਨੂੰ ਪੇਸ਼ ਆਉਣਾ ਪੈਂਦਾ ਹੈ ਜਿਵੇਂ ਕਿ ਬੈਂਕ ਦੇ ਕਾਗਜ਼ ਵਰਕਰ ਵਰਕ ਬਹੁਤ ਟਾਈਮ ਲੱਗਦਾ ਕਦੇ ਫਾਰਮ ਭਰੋ ਕਦੇ ਫਾਰਮ ਗਲਤ ਹੋ ਜਾਂਦਾ ਕਦੇ ਸਿਗਨੇਚਰ ਮੈਚ ਨਹੀਂ ਕਰਦੇ ਲੰਬੀਆਂ ਲੰਬੀਆਂ ਕਤਾਰਾਂ 'ਚ ਖਲੋਣਾ ਪੈਂਦਾ ਹੈ ਜਿਸ ਕਾਰਨ ਸਾਡਾ ਬਹੁਤ ਸਾਰਾ ਟਾਈਮ ਵੇਸਟ ਹੁੰਦਾ ਹੈ ਔਰ ਸਾਡੇ ਹੋਰ ਦੂਸਰੇ ਕੰਮ ਵੀ ਅਸੀਂ ਜ ਨਹੀਂ ਕਰ ਪਾ ਸਕਦੇ ਕਿਉਂਕਿ ਬੈਂਕ ਵਿੱਚ ਲਾਈਨਾਂ ਹੀ ਇੰਨੀਆਂ ਲੰਬੀਆਂ ਹੁੰਦੀਆਂ ਹੈ ਵੀ ਸਾਨੂੰ ਲਾਈਨਾਂ 'ਚ ਖਲੋਤੇ ਖਲੋਤੇ ਪੂਰਾ ਪੂਰਾ ਦਿਨ ਹੀ ਸਾਡਾ ਬਰਬਾਦ ਹੋ ਜਾਂਦਾ ਬੈਂਕ 'ਚ ਹੋਰ ਪੇਪਰ ਵਰਕ ਦਾ ਬਹੁਤ ਜ਼ਿਆਦਾ ਕੰਮ ਪਾਉਂਦੇ ਨੇ ਦੂਸਰਾ ਸਾਨੂੰ ਆਪ ਕਹਿੰਦੇ ਨੇ ਕਿ ਤੁਸੀਂ ਇਹ ਫਾਰਮ ਭਰੋ ਇੱਦਾਂ ਭਰੋ ਕਈ ਵਾਰ ਸਾਨੂੰ ਨਹੀਂ ਪਤਾ ਲੱਗਦਾ ਕਿ ਫਾਰਮ 'ਚ ਕੀ ਲਿਖਿਆ ਕੀ ਨਹੀਂ ਲਿਖਿਆ ਅਸੀਂ ਗਲਤ ਭਰ ਦਿੰਦੇ ਹਾਂ ਫਿਰ ਉਹ ਸਾਡਾ ਫਾਰਮ ਕੈਂਸਲ ਕਰ ਦਿੰਦੇ ਨੇ ਦੁਬਾਰਾ ਫਿਰ ਅਸੀਂ ਲਾਈਨ 'ਚ ਫਾਰਮ ਭਰਦੇ ਹਾਂ ਅਤੇ ਦੁਬਾਰਾ ਫਿਰ ਹਾਨੂੰ ਪਿੱਛੇ ਲੈਨ 'ਚ ਖੜਾ ਹੋਣਾ ਪੈਂਦਾ ਜਿਸ ਕਰਕੇ ਹਾਡਾ ਬਹੁਤ ਸਾਰਾ ਟਾਈਮ ਵੇਸਟ ਹੋ ਜਾਂਦਾ ਹੈ ਜੇ ਅਸੀਂ ਕਦੇ ਫਾਰਮ ਭਰ ਕੇ ਦਿੰਦੇ ਹਾਂ ਅਤੇ ਜਦੋਂ ਸਾਡਾ ਨੰਬਰ ਆਉਂਦਾ ਕਾਊਂਟਰ 'ਤੇ ਉਹ ਕਾਊਂਟਰ ਵਾਲੇ ਕਹਿੰਦੇ ਨੇ ਕਿ ਇਹਦੇ ਨਾਲ ਆਧਾਰ ਕਾਰਡ ਦੀ ਕਾਪੀ ਲਗਾਓ ਫਲਾਣੀ ਕਾਪੀ ਲਗਾਓ ਕੋਈ ਜਨਮ ਸਰਟੀਫਿਕੇਟ ਦੀ ਕਾਪੀ ਲਗਾਓ ਫਿਰ ਸਾਨੂੰ ਬਾਹਰ ਜਾਣਾ ਪੈਂਦਾ ਬੈਂਕ ਚੋਂ ਫੋਟੋ ਕਾਪੀਆਂ ਕਰਵਾਉਣੀਆਂ ਪੈਂਦੀਆਂ ਉਸ ਤੋਂ ਬਾਅਦ ਦੁਬਾਰਾ ਫਿਰ ਆ ਕੇ ਸਾਨੂੰ ਮੁੜ ਤੋਂ ਲੈਨ ਵਿਚ ਖੜਾ ਹੋਣਾ ਪੈਂਦਾ ਹੈ